ਭਾਰਤ ਵਿੱਚ ਬਹੁਤ ਸਾਰੀਆਂ ਪ੍ਰਸਿੱਧ ਬਹੁਤ ਸਾਰੀਆਂ ਫੇਮਸ ਖੇਡਾਂ ਹਨ ਜਿਵੇਂ ਕਿ ਬਾਕਸਿੰਗ ਬੈਡਮਿੰਟਨ ਬਸਕਿਟਬੋਲ ਕ੍ਰਿਕਟ ਹਾਕੀ ਹੋਰ ਵੀ ਬਹੁਤ ਸਾਰੀਆਂ ਖੇਡਾਂ ਹਨ ਅਤੇ ਇਹਨਾਂ ਸਾਰੀਆਂ ਖੇਡਾਂ ਵਿੱਚ ਸਭ ਤੋਂ ਵਧੀਆ ਐਥਲੀਟਸ ਜਿਵੇਂ ਕਿ ਸਚਿਨ ਤੇਂਦੁਲਕਰ ਜੋ ਕਿ ਕ੍ਰਿਕਟ ਵਿੱਚ ਬਹੁਤ ਵਧੀਆ ਸਨ ਦੌੜ ਵਿੱਚ ਮਿਲਖਾ ਸਿੰਘ ਮੈਰੀਕੋਮ ਸਾਡੇ ਬਾਕਸਰ ਦੇ ਹਨ ਅਤੇ ਬਾਕੀ ਹੋਰ ਵੀ ਜਿਵੇਂ ਵਿਰਾਟ ਕੋਹਲੀ ਅਤੇ ਹੋਰ ਵੀ ਬ ਬਹੁਤ ਬਹੁਤ ਜਾਣੇ ਹਨ ਜਿਹਨਾਂ ਨੇ ਇਹ ਫੀਲਡ ਵਿੱਚ ਬਹੁਤ ਸਾਰੇ ਮੈਡਲ ਬਹੁਤ ਸਾਰੀਆਂ ਟਰੋਫੀਆਂ ਬਹੁਤ ਸਾਰਾ ਮਾਣ ਸਨਮਾਨ ਜਿੱਤਿਆ ਅਤੇ ਅੱਜ ਕੱਲ੍ਹ ਦੇ ਲੋਕ ਤਾਂ ਸਾਰਾ ਦਿਨ ਮੋਬਾਇਲ 'ਤੇ ਲੱਗੇ ਰਹਿੰਦੇ ਆ ਕੋਈ ਵੀ ਬਾਹਰ ਜਿਵੇਂ ਖੇਡਣ ਨਹੀਂ ਜਾਂਦਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਤੱਕ ਨਹੀਂ ਪਤਾ ਕਿ ਪੁਰਾਣੇ ਸਮੇਂ ਵਿੱਚ ਕੀ ਖੇਡਾਂ ਖੇਡੀਆਂ ਜਾਂਦੀਆਂ ਸੀ ਜਿਵੇਂ ਕਿ ਸਟੈਪੂ ਡਿਕਰੀਖਾਨਾ ਪਿੱਠੂ ਇਹੋ ਜਿਹੀਆਂ ਚੀਜ਼ਾਂ ਜਿਹਨਾਂ ਨਾਲ ਆਪਣੀ ਆਰਥਿਕ ਸਾਰੀ ਸਿਹਤ ਵੀ ਵਧੀਆ ਰਹਿੰਦੀ ਹੈ ਅਤੇ ਜਿਹਦੇ ਨਾਲ ਆਪਣਾ ਮਾਇੰਡ ਵੀ ਬਹੁਤ ਫਰੈਸ਼ ਰਹਿੰਦਾ ਅਤੇ ਹੋਰ ਵੀ ਕਾਫੀ ਚੀਜ਼ਾਂ ਆਪਾਂ ਨੂੰ ਸਿੱਖਣ ਨੂੰ ਵੀ ਮਿਲਦੀਆਂ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਪਰ ਅੱਜ ਕੱਲ੍ਹ ਦੇ ਲੋਕ ਮੇਰੇ ਕੋਲ ਖੁਦ ਇੰਨਾ ਸਮਾਂ ਨਹੀਂ ਹੁੰਦਾ ਬਟ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਜ਼ਰੂਰ ਇਹ ਸਾਰੀਆਂ ਖੇਡਾ ਖੇਡਣਾ ਚਾਹਾਂਗਾ